ਮੇਰਾ ਪਸੰਦੀਦਾ ਲੇਖਕ ਪੂਰਨ ਸਿੰਘ ਹੈ ਜਿਸ ਦੀ ਇੱਕ ਕਿਤਾਬ ਲਿਖੀ ਹੋਈ ਹੈ ਦਸ ਗੁਰੂ ਸਾਹਿਬਾਨ ਇਹ ਕਿਤਾਬ ਪੂਰੇ ਵਰਲਡ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਕਿਤਾਬ ਵਿੱਚ ਸਿੱਖ ਧਰਮ ਦਾ ਵੇਰਵਾ ਦਿਖਾਇਆ ਗਿਆ ਕਿ ਇਸ ਤਰ੍ਹਾਂ ਸਿੱਖ ਧਰਮ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਹਨ ਕੁਰਬਾਨੀਆਂ ਹੋਈਆਂ ਹਨ ਇਸ ਵਿੱਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਪਰਿਵਾਰ ਦਾ ਵਿਛੋੜਾ ਦਿਖਾਇਆ ਗਿਆ ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਦੇ ਪਰਿਵਾਰ ਦੀ ਕੁਰਬਾਨੀਆਂ ਕੁਰਬਾਨੀਆਂ ਕਿਵੇਂ ਅਤੇ ਕਿਸ ਤਰ੍ਹਾਂ ਹੋਈਆਂ ਸਿੱਖ ਧਰਮ ਸਿੱਖ ਧਰਮ ਇਤਿਹਾਸ ਦਾ ਪੂਰਾ ਪੂਰਾ ਵੇਰਵਾ ਇਸ ਕਿਤਾਬ ਵਿੱਚ ਦਿਖਾਇਆ ਗਿਆ ਇਸ ਕਿਤਾਬ ਵਿਚ ਦਿਖਾਇਆ ਗਿਆ ਹੈ